ਅੱਜ ਕੱਲ੍ਹ ਪੰਜਾਬ ਵਿੱਚ ਜਿਹੜੀ ਸਿਹਤ ਹੈਗਾ ਸਿਹਤ ਦੀ ਜਿਹੜੀ ਸੰਭਾਲ ਹੈ ਉਹ ਸਾਡੇ ਹੱਥ ਵਿੱਚ ਹੀ ਹੁੰਦੀ ਹੈ ਜੇ ਅਸੀਂ ਘਰ ਦਾ ਤਾਜ਼ਾ ਭੋਜਨ ਖਾਵਾਂਗੇ ਫਲ ਫਰੂਟ ਖਾਵਾਂਗੇ ਉਹ ਨਾਲ ਸਾਡਾ ਸਰੀਰ ਬਿਲਕੁਲ ਹੀ ਮਤਲਬ ਸਹੀ ਰਹੇਗਾ ਤੰਦਰੁਸਤ ਰਹੇਗਾ ਅਸੀਂ ਜੇ ਬਾਹਰ ਦਾ ਜੰਕ ਫੂਡ ਹੀ ਖਾਂਦੇ ਰਹਾਂਗੇ ਤਾਂ ਸਾਨੂੰ ਸਾਡੇ ਜਿਹੜਾ ਸਰੀਰ ਦੇ ਜਿਹੜੇ ਅੰਦਰ ਨਿਊਟਰੀਸ਼ਨ ਵਗੈਰਾ ਉਹ ਨਹੀਂ ਮਿਲ ਪਾਉਣਗੇ ਅਤੇ ਸਾਨੂੰ ਹਮੇਸ਼ਾ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਦਵਾਈਆਂ ਖਾਣੀਆਂ ਪੈਂਦੀਆਂ ਨੇ ਜਿਹਦੇ ਕਰਕੇ ਸਾਨੂੰ ਕਮਜ਼ੋਰੀ ਸਰੀਰ 'ਚ ਫੀਲ ਕਰਦੀ ਹੈ ਕਮਜ਼ੋਰੀ ਆ ਜਾਂਦੀ ਹੈ ਸਰੀਰ ਵਿੱਚ ਇਸ ਕਰਕੇ ਕਹਿੰਦੇ ਨੇ ਹਮੇਸ਼ਾ ਘਰ ਦਾ ਤਾਜ਼ਾ ਬਣਿਆ ਹੋਇਆ ਹੀ ਖਾਉ ਫਲ ਫਰੂਟ ਖਾਉ ਜਿਹਦੇ ਨਾਲ ਸਾਨੂੰ ਕੈਲਸ਼ੀਅਮ ਮਿਲੇ ਪ੍ਰੋਟੀਨ ਮਿਲੇ ਨਿਊਟਰੀਸ਼ਨ ਮਿਲੇ ਜਿਹਦੇ ਨਾਲ ਬੱਚੇ ਵੀ ਤੰਦਰੁਸਤ ਰਹਿਣ ਘਰ ਦਾ ਹਰ ਇੱਕ ਮੈਂਬਰ ਜਿਹੜਾ ਹੈ ਬਿਲਕੁਲ ਸਹੀ ਸਲਾਮਤ ਰਹੇ ਸਾਨੂੰ ਡੋਕਟਰਾਂ ਕੋਲ ਜ਼ਿਆਦਾ ਦੇਰ ਨਾ ਨਾ ਜਾਣਾ ਪਵੇ ਆਪਣੀ ਹੈਲਥ ਉੱਤੇ ਹਮੇਸ਼ਾ ਧਿਆਨ ਰੱਖੋ ਸਾਫ ਸੁਥਰਾ ਭੋਜਨ ਖਾਉ ਸਾਫ ਸੁਥਰਾ ਪਾਣੀ ਪੀਉ ਹਰ ਇੱਕ ਚੀਜ਼ ਜਿਹੜੀ ਵੀ ਹੈ ਸਾਫ ਸੁਥਰੀ ਸਾਨੂੰ ਖਾਣੀ ਚਾਹੀਦੀ ਹੈ ਘਰ ਦੀ ਬਣੀ ਹੋਈ ਤਾਜ਼ੀ ਹੀ ਖਾਣੀ ਚਾਹੀਦੀ ਹੈ ਬਾਹਰ ਦਾ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਜਿਹਦੇ ਕਰਕੇ ਸਾਨੂੰ ਜ਼ਿਆਦਾ ਬਿਮਾਰ ਹੋਣਾ ਪਵੇ ਜਾਂ ਸਾਨੂੰ ਦਵਾਈਆਂ ਦਾ ਸਾਹਮਣਾ ਕਰਨਾ ਪਵੇ ਜਾਂ ਸਾਨੂੰ ਵਾਰ ਵਾਰ ਹੋਸਪੀਟਲ ਵਗੈਰਾ ਜਾਣਾ ਪਵੇ ਇਸ ਕਰਕੇ ਕਹਿੰਦੇ ਨੇ ਹਮੇਸ਼ਾ ਘਰ ਦਾ ਸਾਫ ਸੁਥਰਾ ਭੋਜਨ ਹੀ ਖਾਧਾ ਜਾਵੇ